ਪੰਜਾਬ ਇੱਕ ਮੈਦਾਨੀ ਖੇਤਰ ਹੋਣ ਕਰਕੇ ਇੱਥੇ ਪਹਾੜ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਕੁਝ ਹੀ ਇਲਾਕੇ ਐਵੇਂ ਦੇ ਹਨ ਜਿੱਥੇ ਛੋਟੇ ਛੋਟੇ ਟਿੱਬੇ ਪਾਏ ਜਾਂਦੇ ਹਨ ਪਰ ਇੱਥੇ ਜੰਗਲ ਬਹੁਤ ਜ਼ਿਆਦਾ ਪਾਏ ਜਾਂਦੇ ਹਨ ਜਿਵੇਂ ਕਿ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਖੇਤਰ ਇੱਕ ਐਵੇਂ ਦਾ ਖੇਤਰ ਹੈ ਜਿਸ ਨੂੰ ਜੰਗਲ ਪ੍ਰਭਾਵਿਤ ਖੇਤਰ ਕਿਹਾ ਜਾਂਦਾ ਹੈ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ ਜੰਗਲ ਇਸ ਹੀ ਜ਼ਿਲ੍ਹੇ ਵਿੱਚ ਪਾਏ ਜਾਂਦੇ ਹਨ ਬਹੁਤ ਸਾਰੇ ਸੈਲਾਨੀ ਦੂਰ ਦੂਰ ਤੋਂ ਆ ਕੇ ਇੱਥੇ ਟ੍ਰੈਕਿੰਗ ਕਰਦੇ ਹਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਦੁਆਰਾ ਇੱਥੇ ਅਧਿਆਪਕਾਂ ਦੁਆਰਾ ਇੱਥੇ ਲਿਆਇਆ ਜਾਂਦਾ ਹੈ ਤਾਂ ਜੋ ਬੱਚੇ ਇੱਥੇ ਟ੍ਰੈਕਿੰਗ ਕਰਕੇ ਕੁਛ ਨਵਾਂ ਸਿੱਖ ਸਕਣ ਅਤੇ ਵਾਤਾਵਰਣ ਨਾਲ਼ ਕੁਦਰਤ ਨਾਲ਼ ਜੁੜ ਸਕਣ ਅਤੇ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਵਾਟਰ ਸੋਰਸਸ ਵੀ ਪਾਏ ਜਾਂਦੇ ਹਨ ਜਿਵੇਂ ਕਿ ਭਾਖੜਾ ਡੈਮ ਨੰਗਲ ਡੈਮ ਸ਼ਿਸ਼ਮਾ ਡੈਮ ਜਿੱਥੇ ਬਹੁਤ ਦੂਰ ਦੂਰ ਤੋਂ ਵੀ ਸੈਲਾਨੀ ਆਉਂਦੇ ਹਨ ਬੋਟਿੰਗ ਕਰਦੇ ਹਨ ਅਤੇ ਫੋਟੋਆਂ ਖਿਚਵਾਉਂਦੇ ਹਨ ਅਤੇ ਕੁਦਰਤ ਨਾਲ਼ ਜੁੜੇ ਰਹਿੰਦੇ ਹਨ